ਸਮਕਾਲੀ ਪੰਜਾਬੀ ਸੰਗੀਤ ਬਾਰੇ ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹਾਂ ਸਮਕਾਲੀ ਪੰਜਾਬੀ ਸੰਗੀਤ ਸੀ ਜੋ ਉਹ ਸਾਡੇ ਵਿਰਸੇ ਦਾ ਇੱਕ ਹਿੱਸਾ ਸੀ ਸੋ ਅਸੀਂ ਸਮਕਾਲੀ ਪੰਜਾਬੀ ਸੰਗੀਤ ਨੂੰ ਆਪਣੇ ਪਰਿਵਾਰਕ ਆਪਣੇ ਰਿਸ਼ਤੇਦਾਰ ਅਤੇ ਆਪਣੇ ਆਂਢ ਗਵਾਂਢ ਦੇ ਵਿੱਚ ਬੈਠ ਕੇ ਸੁਣ ਸਕਦੇ ਸੀ ਜਿਵੇਂ ਕਿ ਘੋੜੀਆਂ ਬੋਲੀਆਂ ਸਿੱਠਣੀਆਂ ਲੋਕ ਤੱਤ ਗੀਤ ਸੀ ਅਤੇ ਇਹ ਪਰਿਵਾਰਾਂ ਦੀ ਸਾਂਝ ਵੀ ਸੀ

ਜੋ ਅੱਜ ਦੇ ਗੀਤ ਨੇ ਇਹਨਾਂ ਵਿੱਚ ਲੱਚਰਤਾ ਹਥਿਆਰ ਅਤੇ ਅਸ਼ਲੀਲ ਤਾ ਭਰੀ

ਸੋ ਜੋ ਸਾਡਾ ਸਮਕਾਲੀ ਪੰਜਾਬੀ ਸੰਗੀਤ ਸੀ ਉਹ ਸਾਡੇ ਤੋਂ ਖੋਹ ਲਿਆ ਗਿਆ ਹੈ ਸਾਨੂੰ ਉਸ ਸਮਕਾਲੀ ਪੰਜਾਬੀ ਸੰਗੀਤ ਨੂੰ ਵਾਪਸ ਲਿਆਉਣ ਦੀ ਬਹੁਤ ਲੋੜ ਹੈ